ਨਵ ਜੰਮੇ ਬੱਚਿਆਂ ਲਈ ਸੁਰੱਖਿਅਤ ਵਾਤਾਵਰਨ ਸਵੱਛ ਵਾਤਾਵਰਨ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੀ ਸਾਫ ਸਫਾਈ ਦਾ ਖਿਆਲ ਰੱਖਿਆ ਜਾਵੇ ਕਿਉਂਕਿ ਬੱਚੇ ਛੋਟੇ ਬੱਚਿਆਂ ਨੂੰ ਬੈਕਟੀਰੀਆ ਬਹੁਤ ਜਲਦੀ ਅਸਰ ਕਰਦੇ ਹਨ ਅਤੇ ਉਹ ਜਲਦੀ ਹੀ ਬਿਮਾਰ ਪੈ ਜਾਂਦੇ ਹਨ ਇਸ ਲਈ ਸਵੱਛ ਵਾਤਾਵਰਨ ਬਣਾਉਣ ਲਈ ਉਹਨਾਂ ਦੇ ਸਾਫ ਕੱਪੜੇ ਅਤੇ ਡਟੋਲ ਵਗੈਰਾ ਵਰਤਿਆ ਜਾਵੇ ਤਾਂ ਜੋ ਉਨਾਂ ਦੇ ਕੱਪੜੇ ਬੈਕਟੀਰੀਆ ਫਰੀ ਹੋ ਸਕਣ ਨਾਲ ਹੀ ਮਾਂ ਬਾਪ ਨੂੰ ਬੱਚਿਆਂ ਨੂੰ ਗੰਦੇ ਹੱਥ ਨਹੀਂ ਲਗਾਉਣੇ ਚਾਹੀਦੇ ਇਸ ਨਾਲ ਬੱਚੇ ਦੀ ਸਿਹਤ ਤੰਦਰੁਸਤ ਹੋਵੇਗੀ ਅਤੇ ਨਾ ਹੀ ਉਹ ਜਲਦੀ ਬਿਮਾਰ ਹੋਣਗੇ ਧੰਨਵਾਦ